ਹੈਲੋ ਹਾਂਜੀ ਹੈਲੋ ਹਾਂਜੀ ਜੀ ਹਾਂਜੀ ਹਾਂਜੀ ਸਰ ਬਿਲਕੁਲ ਜੀ ਜੀ ਜੀ ਦੇਖੋ ਇਹ ਯੋਗਾ ਤੋ ਕਾਫ਼ੀ ਅੱਛਾ ਬੈਨੀਫਿਟਸ ਹੈ ਖ਼ਾਸ ਕਰਕੇ ਵਰਕਿੰਗ ਵੋਮੈਨ ਵਾਸਤੇ ਤੋ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਆਪਾਂ ਦੇਖਦੇ ਹੈ ਕਿ ਵਰਕਿੰਗ ਵੋਮੈਨ ਠੀਕ ਹੈ ਘਰ ਦੇ ਵਿੱਚ ਸਾਰਾ ਦਿਨ ਕੰਮ ਕਰਨਾ ਬੱਚਿਆਂ ਨਾਲ ਰਹਿਣਾ ਬੱਚਿਆਂ ਦਾ ਪੇਰੈਂਟਸ ਹੁੰਦੇ ਹੈ ਹਸਬੈਂਡ ਹੁੰਦਾ ਜਿਨ੍ਹਾਂ ਵਿੱਚ ਕੰਮ ਕਰਦੇ ਕਾਫੀ ਉਲਝ ਜਾਂਦੇ ਹੈ ਠੀਕ ਹੈ ਜਿਹਦੇ ਕਰਕੇ ਉਹ ਮੈਂਟਲੀ ਕਾਫ਼ੀ ਥੋੜ੍ਹਾ ਜਿਹਾ ਡਿਸਟਰਬ ਹੋ ਜਾਂਦੇ ਹੈ ਥੋੜ੍ਹੀ ਬਹੁਤ ਸਾਰੀ ਪ੍ਰੇਸ਼ਾਨੀਆਂ ਹੁੰਦੀ ਹੈ ਠੀਕ ਹੈ ਤੋ ਉਹਦੇ ਵਿੱਚ ਯੋਗਾ ਕਾਫ਼ੀ ਬੈਨੀਫਿਟ ਹੋ ਸਕਦਾ ਹੈ ਜਿਵੇਂ ਕਿ ਮੈਂਟਲੀ ਸਟਰੈਸ ਨੂੰ ਬਾਹਰ ਕੱਢਣ ਵਾਸਤੇ ਠੀਕ ਹੈ ਇਸ ਕਰਕੇ ਯੋਗਾ ਇੱਕ ਬੜਾ ਬੈਨੇਫਿਸ਼ਲੀ ਚੀਜ਼ ਹੈ ਜਿਹਦੇ ਵਿੱਚ ਆਪਾਂ ਸਵੇਰੇ ਸਵੇਰੇ ਯੋਗ ਪ੍ਰਾਣਾਯਾਮ ਕਰਦੇ ਹੈ ਇਹਦੇ ਕਰਕੇ ਮੈਡੀਟੇਸ਼ਨ ਹੋਰ ਵੀ ਛੋਟੇ ਛੋਟੇ ਯੋਗਾ ਹੈ ਜੋ ਲੇਡੀਜ ਵਾਸਤੇ ਕੀਤਾ ਜਾ ਸਕਦਾ ਹੈ ਠੀਕ ਹੈ ਤੇ ਇਹਦੇ ਵਿੱਚ ਅਗਰ ਤੁਸੀਂ ਚਾਹੋ ਤਾਂ ਜੋਇਨ ਕਰ ਸਕਦੇ ਟਾਈਮਿੰਗ ਦੇਖੋ ਜੀ ਟਾਈਮਿੰਗ ਇਹਦਾ ਇਹ ਹੀ ਹੈ ਕਿ ਸਵੇਰੇ ਤਾਂ ਲੇਡੀਸ ਸਮਝੋ ਘਰ ਦਾ ਕੰਮ ਕੁੰਮ ਵੀ ਕਰਦੇ ਬੀਜੀ ਰਹਿੰਦੇ ਹੈ ਠੀਕ ਹੈ ਨਾ ਉਹਦੇ ਵਿੱਚ ਆਪਾਂ ਦੋ ਟਾਈਮ ਰੱਖੇ ਇੱਕ ਸਵੇਰੇ ਛੇ ਵਜੇ ਤੋਂ ਪਹਿਲੇ ਇੱਕ ਛੇ ਵਜੇ ਸ਼ੁਰੂ ਕਰਦੇ ਘਰ ਦਾ ਕੰਮ ਛੇ ਤੋਂ ਲੈ ਕੇ ਨੌਂ ਦਸ ਵੱਜ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਖਾਣਾ ਬਾਣਾ ਖਾ ਕੇ ਬ੍ਰੇਕਫਾਸਟ ਕਰਕੇ ਯੋਗਾ ਕਰਨ ਤੋਂ ਮਤਲਬ ਕਿ ਫਿਰ ਤੁਸੀਂ ਬਾਰਾਂ ਵਜੇ ਦਾ ਸੈਸ਼ਨ ਲੈ ਸਕਦੇ ਹੋ ਬਾਰਾਂ ਤੋਂ ਇੱਕ ਕਿਉਂਕਿ ਉਹ ਫ੍ਰੀ ਟਾਈਮ ਕਿਉਂਕਿ ਖਾਣਾ ਬਾਣਾ ਖਾ ਕਰ ਦੋ ਘੰਟੇ ਕਾ ਗੈਪ ਹੋਵੇ ਫਿਰ ਯੋਗਾ ਕੀਤਾ ਜਾ ਸਕਦਾ ਵਧੀਆ ਰਹਿੰਦਾ ਅਤੇ ਖਾਨਾ ਖਾ ਕੇ ਤੁਰੰਤ ਨਹੀਂ ਕਰਨਾ ਹੁੰਦਾ ਉਹ ਹੁੰਦਾ ਹੈ ਜਾਂ ਫਿਰ ਤੁਸੀਂ ਸ਼ਾਮੀ ਦੁਪਹਿਰ ਤੋਂ ਲੰਚ ਤੋਂ ਬਾਅਦ ਦਾ ਟਾਈਮ ਚਾਰ ਵਜੇ ਤੋਂ ਪਹਿਲੇ ਤਿੰਨ ਤੋਂ ਲੈ ਕੇ ਚਾਰ ਦੇ ਵਿੱਚ

ਉਸ ਤੋਂ ਬਾਅਦ ਫਿਰ ਰਾਤ ਦਾ ਹੈ ਸੈਸ਼ਨ ਹੈ ਅੱਠ ਤੋਂ ਨੌਂ ਕਿਉਂਕਿ ਸਪੈਸ਼ਲੀ ਇਹ ਸ਼ਡਿਊਲ ਮੋਡੀਫਾਈ ਕੀਤਾ ਹੋਇਆ ਵਰਕਿੰਗ ਵੋਮੈਨ ਵਾਸਤੇ ਕਿਉਂਕਿ ਉਨ੍ਹਾਂ ਦੇ ਘਰ ਦਾ ਕੰਮ ਕਾਰ ਦੇਖ ਕੇ ਬੱਚੇ ਦਾ ਪੇਰੈਂਟਸ ਦਾ ਖਾਣਾ ਬਾਣਾ ਬਣਾਉਣਾ ਇਨ੍ਹਾਂ ਸਾਰਿਆਂ ਨੂੰ ਕੱਢ ਕੇ ਫਿਰ ਇਹ ਸ਼ਡਿਊਲ ਕੀਤਾ ਹੋਇਆ ਵਾ

ਡਿਸਕਾਊਂਟ ਦਾ ਸਰ ਕੋਈ ਚੱਕਰ ਨਹੀਂ ਹੈ ਹੋ ਜਾਣਾ ਸਾਰਾ ਕੁਛ ਇੱਕ ਵਾਰੀ ਤੁਸੀਂ ਡੈਮੋ ਕਲਾਸ ਲੈ ਸਕਦੇ ਹੋ ਦੇਖੋ ਇੱਕ ਦੋ ਦਿਨ ਦੇਖ ਕੇ ਇਹਦਾ ਕੀ ਬੈਨੀਫਿਟਸ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਅੱਛਾ ਲਗੁਗਾ ਤਾਂ ਔਟੋਮੈਟਿਕ ਸਾਰਾ ਕੁਛ ਹੋਏਗਾ ਅਡਰੈਸ ਸਰ ਤੁਸੀਂ ਕਪੂਰਥਲੇ ਹਾਂਜੀ ਦੇ ਕੋਲ ਜਦੋਂ ਮਰਜੀ ਆਓ ਆ ਕੇ ਇੱਕ ਵਾਰੀ ਵਿਜਿਟ ਕਰਨਾ ਚਾਹੀਦਾ ਹੈ ਤਾਂ ਕਿ ਦੇਖਣਾ ਚਾਹੀ ਬਹੁਤ ਸਾਰੇ ਤੁਹਾਡੇ ਇੱਥੇ ਦੇ ਬਹੁਤ ਸਾਰੇ ਲੇਡੀਸ ਹੈਗੇ ਜਿਹੜੇ ਆਉਂਦੇ ਹੈ ਉਨ੍ਹਾਂ ਨੂੰ ਕਾਫੀ ਬੈਨੀਫਿਟਸ ਹੋਇਆ ਵਾ

ਬਿਲਕੁਲ ਉਹ ਸਾਰਾ ਚੀਜ਼ਾਂ ਦੇਖ ਕੇ ਫਿਰ ਤੁਸੀਂ ਕਹਿ ਸਕਦੇ ਬਾਕੀ ਅੱਛਾ ਹੈ ਜਦੋਂ ਮਰਜੀ ਵਿਜਿਟ ਕਰੋ ਟਵੈਂਟੀ ਫੋਰ ਆਵਰ ਓਪਨ ਹੈ ਪਰ ਜੋ ਸ਼ਡਿਊਲ ਹੈ ਟਾਈਮਿੰਗ ਤੁਹਾਨੂੰ ਮੈਂ ਦੱਸਿਆ ਹੈ ਉਹ ਹੈਗਾ ਲੇਡੀਸ ਵਾਸਤੇ ਸਪੈਸ਼ਲੀ ਫੋਰ ਵੋਮੈਨ ਵਰਕਿੰਗ ਵੋਮੈਨ ਵਾਸਤੇ ਸ਼ਡਿਊਲ ਕੀਤਾ ਹੋਇਆ ਵਾ ਕਦੋਂ ਆਓਗੇ ਸਰ ਠੀਕ ਹੈ ਸਰ ਹਾਂ ਔਨਲਾਈਨ ਵੀ ਹੁੰਦਾ ਸੈਸ਼ਨ ਜਿਹੜਾ ਕੋਈ ਅਗਰ ਫਿਜੀਕਲੀ ਨਹੀਂ ਆ ਸਕਦਾ ਉਹ ਔਨਲਾਈਨ ਵੀ ਹੈ ਠੀਕ ਹੈ ਓਕੇ ਥੈਂਕਿਊ ਸਰ